ਹਰ ਕੰਮ ਨੂੰ ਕਰਨ ਵਾਸਤੇ ਸਾਨੂੰ ਪੈਸੇ ਦੀ ਲੋੜ ਹੁੰਦੀ ਹੈ ਤੇ ਉਹ ਪੈਸੇ ਨੂੰ ਕਿਵੇਂ ਇਕੱਠਾ ਕਰਨਾ ਹੈ ਇਹ ਇਕ ਹੁਨਰ ਬਾਅਦ ਇਨਸਾਨ ਹੀ ਜਾਣਦਾ ਹੈ ਤੇ ਉਹ ਪੈਸੇ ਨੂੰ ਕਿਵੇਂ ਵਰਤੋ ਕਰਤੀ ਜਾਂਦੀ ਹੈ ਇਹ ਸਹੀ ਤਰੀਕੇ ਨਾਲ ਆਪਾਂ ਜਦੋਂ ਡਿਸੀਜ਼ਨ ਲੈਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਸਹੀ ਨਤੀਜਾ ਹੀ ਸਾਡੇ ਲਈ ਅੱਛਾ ਹੁੰਦਾ ਜੇ ਪੈਸੇ ਨੂੰ ਸਹੀ ਜਗ੍ਹਾ ਲਗਾਵਾਂਗੇ ਤਾਂ ਹੀ ਸਾਨੂੰ ਜਿਆਦਾ ਤੋਂ ਜਿਆਦਾ ਮੁਨਾਫਾ ਹੋਵੇਗਾ ਤੇ ਇਹਨੂੰ ਲਗਾਉਣ ਵਾਸਤੇ ਸਾਨੂੰ ਹਰ ਤਰੀਕੇ ਦੀ ਜਾਂਚ ਕਰਨੀ ਪੈਂਦੀ ਹੈ ਸਾਨੂੰ ਆਪਣਾ ਪ੍ਰੋਪਰ ਬਜਟ ਬਣਾਉਣਾ ਪੈਂਦਾ ਹੈ ਤੇ ਉਹਦੇ ਵੀ ਸਾਨੂੰ ਦੱਸਣਾ ਪੈਂਦਾ ਹੈਗਾ ਕਿ ਆਪਾਂ ਕਿਸ ਕਿਸ ਦੇ ਵਿੱਚ ਇਹਨੂੰ ਯੂਜ ਕਰ ਰਹੇ ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਵੀ ਵਰਤੋਂ ਸਿਰਫ ਅ ਸਿਰਫ ਆਪਾਂ ਕੰਮਾਂ ਨੂੰ ਵਿੱਚ ਕੰਮ ਕਰਨ ਵਾਸਤੇ ਜਾਂ ਫਿਰ ਬਾਜ਼ਾਰ ਦੇ ਵਿੱਚ ਕੁਝ ਸਮਾਨ ਲੈ ਕੇ ਜਾਣ ਵਾਸਤੇ ਵੀ ਕਰ ਸਕਦੇ ਹਾਂ ਆਪਾਂ ਪੈਸੇ ਦੀ ਦਾ ਸੀਜਨ ਮੇਕਿੰਗ ਆਪਾਂ ਆਪਣੇ ਜਾਗਰੂਕਤਾ ਇਨਵੈਸਟਮੈਂਟ ਵਿੱਚ ਵੀ ਕਰਦੇ ਹਾਂ ਇਹ ਇਨਵੈਸਟਮੈਂਟ ਆਪਾਂ ਆਪਣੇ ਨਾਲੋਂ ਹੀ ਵੱਧ ਕਿਸੇ ਵੀ ਕੰਪਨੀ ਜਾਂ ਫਿਰ ਕਿਸੇ ਵੀ ਸਕੂਲਾਂ ਵਿੱਚ ਕੀਤੀ ਜਾਂਦੀ ਹੈ ਜੇ ਸਕੂਲਾਂ ਵਿੱਚ ਪੈਸੇ ਹੀ ਨਹੀਂ ਹੋਗੇ ਤੇ ਉਹ ਬੱਚਿਆਂ ਨੂੰ ਉੱਚ ਸਿੱਖਿਆ ਹੀ ਨਹੀਂ ਪ੍ਰਾਪਤ ਕਰਨ ਦੇਣਗੇ ਤੇ ਪੈਸੇ ਦੀ ਵੰਡ ਬਹੁਤ ਜਿਆਦਾ ਜ਼ਰੂਰੀ ਹੁੰਦੀ ਹੈ ਤੇ ਪੈਸੇ ਨੂੰ ਪੂਰੀ ਤਰ੍ਹਾਂ ਸੰਭਾਲ ਕੇ ਰੱਖਣਾ ਤੇ ਸਹੀ ਜਗ੍ਹਾ ਲਗਾਉਣ ਦਾ ਹੀ ਇੱਕ ਮੇਨ ਮਹੱਤਵ ਹੁੰਦਾ ਹੈ ਅਗਰ ਪੈਸੇ ਦੀ ਵਰਤੋਂ ਸਹੀ ਜਗ੍ਹਾ ਨਹੀਂ ਕੀਤੀ ਜਾਊਗੀ ਤੇ ਉਹਦਾ ਜਿਹੜਾ ਸਾਨੂੰ ਹੁਨਰ ਐ ਜੇ ਸਾਨੂੰ ਜਿਹੜਾ ਚੀਜ਼ ਆ ਉਹ ਸਾਨੂੰ ਨਹੀਂ ਮਿਲੂਗੀ ਉਸ ਲਈ ਸਾਨੂੰ ਸਹੀ ਜਗ੍ਹਾ ਸਹੀ ਟਾਈਮ ਤੇ ਆਪਣੇ ਪੈਸੇ ਨੂੰ ਦਾਖਿਲ ਕਰਨਾ ਪੈਂਦਾ ਹੈ ਜਾਂ ਫਿਰ ਲਗਾਨਾ ਪੈਂਦਾ ਹੈ ਜਿਸ ਕਰਕੇ ਆਪਾਂ ਆਉਣ ਵਾਲੇ ਸਮੇਂ ਵਿੱਚ ਆਪਣੀ ਇੱਛਾਵਾਂ ਨੂੰ ਪੂਰੀ ਕਰ ਸਕਣ ਇਹ ਫਾਨੈਂਸ਼ਅਲ ਡਿਸੀਜ਼ਨ ਮੇਕਿੰਗ ਦਾ ਇੱਕ ਹਿੱਸਾ ਹੈਵੇਗਾ ਵੈ ਜਿਹਦੇ ਵਿੱਚ ਆਪਣੇ ਉੱਚ ਵਿਅਕਤੀ ਆਪਣੇ ਜਿਹੜੇ ਕੰਪਨੀ ਵਿੱਚ ਲੱਗੇ ਹੁੰਦੇ ਹਨ ਉਹ ਡਿਸਾਈਡ ਕਰਦੇ ਹਨ ਕਿ ਆਪਾਂ ਪੈਸੇ ਨੂੰ ਕਿੱਥੇ ਲਗਾਵਾਂਗੇ ਤੇ ਕਿੱਥੇ ਸਾਨੂੰ ਜਿਆਦਾ ਇਹਦੀ ਉਪਜਾਊ ਹੋਊਗੀ